ਹੈਲੋ ਮੈਂ ਸੁਰਜੀਤ ਕੁਮਾਰ ਪਠਾਨਕੋਟ ਤੋਂ ਬੋਲਦਾ ਹਾਂ ਆਪ ਜੀ ਨੇ ਪੁੱਛਿਆ ਹੈ ਕਿ ਤੁਹਾਨੂੰ ਗੇਮ ਬਾਰੇ ਕੀ ਜਾਣਦੇ ਹੋ ਅਸੀਂ ਗੇਮ ਬਾਰੇ ਬਹੁਤ ਕੁਛ ਜਾਣਦੇ ਹਾਂ ਜਿੱਦਾਂ ਕਿ ਬੱਚਿਆਂ ਦੀ ਖੇਡਣ ਵਾਲੀ ਵੀਡੀਓ ਗੇਮ ਲੁੱਡੋ ਆਦਿ ਵਗੈਰਾ ਗੇਮਾਂ ਜਿਹੜੀਆਂ ਕਿ ਫੋਨ ਦੇ ਵਿੱਚ ਹੁੰਦੀਆਂ ਹਨ ਲੇਕਿਨ ਗੇਮਾਂ ਵਿੱਚੋਂ ਇੱਕ ਗੇਮ ਜਿੱਦਾਂ ਕਿ ਲੁੱਡੋ ਉਹ ਆਮ ਬੰਦਾ ਵੀ ਘਰ ਫੈਮਲੀ ਵਿੱਚ ਰਲ ਕੇ ਖੇਡ ਸਕਦਾ ਹੈ ਇਹ ਗੇਮ ਬਹੁਤ ਹੀ ਮਨ ਨੂੰ ਬਹੁਤ ਹੀ ਅੱਛੀ ਗੇਮ ਹੈ ਅੱਛੀ ਇਸ ਕਾਰਨ ਕਿ ਅਸੀਂ ਫੈਮਲੀ ਵਿੱਚ ਬੈਠ ਕੇ ਖੇਡ ਸਕਦੇ ਹਾਂ ਲੇਕਿਨ ਸਾਡੀ ਹੁਣ ਐਨੀ ਉਮਰ ਹੋ ਚੁੱਕੀ ਹੈ ਇਹ ਹੈ ਕਿ ਅਸੀਂ ਹੁਣ ਗੇਮ ਖੇਡਣਾ ਪਸੰਦ ਨਹੀਂ ਕਰਦੇ ਹੋਰ ਵੀ ਬਹੁਤ ਗੇਮਾਂ ਹਨ ਫੋਨ ਦੇ ਵਿੱਚ ਜਿੱਦਾਂ ਕਾਰਟੂਨ ਵਗੈਰਾ ਫਰੀ ਫਾਇਰ ਉਹ ਵੀ ਕਦੀ ਕਦੀ ਖੇਡਣ ਖੇਡਦੇ ਰਹਿੰਦੇ ਹਨ ਇਸ ਲਈ ਗੇਮ ਨੂੰ ਅਸੀਂ ਇਸ ਲਈ ਪਸੰਦ ਕਰਦੇ ਹਾਂ ਕਿਉਂਕਿ ਇਹ ਜਦੋਂ ਫ੍ਰੀ ਟਾਈਮ ਹੁੰਦਾ ਹੈ ਤਾਂ ਮਨੋਰੰਜਨ ਦਾ ਇੱਕ ਸਾਧਨ ਹੈ ਇਸ ਲਈ ਗੇਮ ਖੇਡਣਾ ਸਾਨੂੰ ਬਹੁਤ ਹੀ ਚੰਗਾ ਲੱਗਦਾ ਹੈ ਇੱਕ ਤਾਂ ਟਾਈਮ ਪਾਸ ਹੋ ਜਾਂਦਾ ਹੈ ਟਾਈਮ ਦਾ ਵੀ ਪਤਾ ਨਹੀਂ ਚੱਲਦਾ